ਕਾਫੀ ਸਾਲ ਪਹਿਲਾਂ ਮਨੋਰੰਜਨ ਦੇ ਸਾਧਨ ਬਹੁਤ ਸੀਮਤ ਸਨ ਪਰ ਅੱਜ ਕੱਲ੍ਹ ਮਨੋਰੰਜਨ ਦੇ ਸਾਧਨਾਂ ਵਿੱਚ ਕਾਫੀ ਵਾਧਾ ਹੋਇਆ ਹੈ ਪਹਿਲੇ ਸਮੇਂ ਵਿੱਚ ਸਿਰਫ ਰੇਡੀਓ ਇੱਕ ਐਟਰਟੇਨਮੈਂਟ ਦਾ ਜ਼ਰੀਆ ਹੁੰਦਾ ਸੀ ਪਰ ਅੱਜ ਕੱਲ੍ਹ ਟੀ ਵੀ ਇੰਟਰਨੈਟ ਨੇ ਐਟਰਟੇਨਮੈਂਟ ਵਿੱਚ ਕਾਫੀ ਅਹਿਮ ਰੋਲ ਅਦਾ ਕੀਤਾ ਹੈ ਪਹਿਲਾਂ ਬੱਚਿਆਂ ਨੂੰ ਘਰਾਂ ਤੋਂ ਬਾਹਰ ਜਾ ਕੇ ਛੋਟੀਆਂ ਮੋਟੀਆਂ ਖੇਡਾਂ ਖੇਡਣੀਆਂ ਪੈਂਦੀਆਂ ਸਨ ਜਿਵੇਂ ਗੁੱਲੀ ਡੰਡਾ ਛੂਹਣ ਛੁਪਾਈ ਸਟਾਪੂ ਵਗੈਰਾ ਪਰ ਅੱਜ ਕੱਲ੍ਹ ਬੱਚਿਆਂ ਦਾ ਕਾਫੀ ਸਮਾਂ ਲੈਪਟੋਪ 'ਤੇ ਜਾਂ ਫਿਰ ਮੋਬਾਈਲਾਂ 'ਤੇ ਜਾਂ ਫਿਰ ਟੀ ਵੀ ਵੇਖਣ 'ਤੇ ਬੀਤਦਾ ਹੈ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਇਹ ਗੈਜੇਟਸ ਐਟਰਟੇਨਮੈਂਟ ਦਾ ਮਨੋਰੰਜਨ ਦਾ ਵਧੀਆ ਜ਼ਰੀਆ ਬਣ ਚੁੱਕੇ ਹਨ ਇੰਟਰਨੈਟ ਤੋਂ ਸਿਰਫ ਤੋਂ ਸਿਰਫ ਸਾਨੂੰ ਮਨਪ੍ਰਚਾਵੇ ਤੁਹਾਡਾ ਮਨ ਪਰਚਾਵਾ ਹੀ ਨਹੀਂ ਹੁੰਦਾ ਸਗੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਅੱਜ ਕੱਲ੍ਹ ਇੰਟਰਨੈਟ ਐਜੂਕੇਸ਼ਨ ਦਾ ਵੀ ਜ਼ਰੀਆ ਬਣ ਚੁੱਕਾ ਹੈ ਇ ਇੰਟਰਨੈਟ ਦੇ ਥਰੂ ਬੱਚੇ ਬਹੁਤ ਕੁਝ ਸਿੱਖ ਸਕਦੇ ਹਨ